ਪੁਰਾਣੇ ਸਮੇਂ ਦੇ ਵਿੱਚ ਕੁਦਰਤੀ ਢੰਗ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਹੁਣ ਹੈ ਜਿਹੜਾ ਕਿਸਾਨ ਖੇਤੀ ਕਰਨ ਸਮੇਂ ਕੀਟਨਾਸ਼ਕ ਦਵਾਈਆਂ ਰੇਹਾਂ ਸਪਰੇਹਾਂ ਦੀ ਵਰਤੋਂ ਕਰਦਾ ਗਾ ਜਿਨ੍ਹਾਂ ਦੇ ਮੁੱਲ ਬਹੁਤ ਜ਼ਿਆਦਾ ਨੇ ਜਿਹਦੇ ਕਰਕੇ ਉਹਨੂੰ ਕਰਜਾ ਚੁੱਕਣਾ ਪੈਂਦਾ ਫਿਰ ਉਹ ਆੜਤੀਆਂ ਤੋਂ ਅਤੇ ਬੈਂਕਾਂ ਤੋਂ ਕਰਜਾ ਲੈਂਦਾ ਬੈਂਕਾਂ ਦੇ ਵਿੱਚ ਆਪਣੀਆਂ ਲਿਮਟਾਂ ਬਣਾਉਂਦਾ ਗਾ ਜਿਹਦੇ ਲਈ ਉਹਨੂੰ ਜ਼ਮੀਨ ਦੇ ਜਿਹੜੇ ਨੰਬਰ ਦੇਣੇ ਪੈਂਦੇ ਨੇ ਜਦੋਂ ਉਹ ਲਿਮਟਾਂ ਵਾਪਿਸ ਨਹੀਂ ਕਰ ਪਾਉਂਦੇ ਤਾਂ ਬੈਂਕ ਵਾਲੇ ਉਹਨਾਂ ਨੂੰ ਤੰਗ ਕਰਦੇ ਨੇ ਅਤੇ ਨਾਲ ਹੀ ਆੜਤੀਆਂ ਦੁਆਰਾ ਵੀ ਸ਼ੋਸ਼ਣ ਕੀਤਾ ਜਾਂਦਾ ਇਸ ਸ਼ੋਸ਼ਣ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਜਿਹੜੇ ਛੋਟੇ ਕਿਸਾਨ ਨੇ ਅਤੇ ਮੀ ਮਾਧਿਅਮ ਵਰਗ ਦੇ ਕਿਸਾਨ ਨੇ ਉਹ ਸ਼ਿਕਾਰ ਹੁੰਦੇ ਨੇ ਜਿਹਨਾਂ ਕੋਲ ਢਾਈ ਏਕੜ ਜਾਂ ਪੰਜ ਏਕੜ ਦੀ ਜ਼ਮੀਨ ਹੈ ਕਿਉਂਕਿ ਉਹ ਕਰਜਾ ਦੇਣ ਤੋਂ ਅਸਮਰਥ ਨੇ ਉਹ ਆਪਣੇ ਦੂਜੇ ਜਿਹੜੇ ਖਰਚੇ ਆ ਉਹਨਾਂ ਨੂੰ ਹੀ ਪੂਰਾ ਨਹੀਂ ਕਰ ਪਾਉਂਦੇ ਫਿਰ ਉਹਨਾਂ ਨੂੰ ਡੇਲੀ ਦੇ ਖਰਚੇ ਪੂਰੇ ਕਰਨ ਦੇ ਲਈ ਕਰਜੇ ਲੈਣੇ ਹੀ ਪੈਂਦੇ ਨੇ